ਜੀ ਹਾਂ ਮੈਂ ਸਵੇਰੇ ਸ਼ਾਮ ਦੌੜਦਾ ਹਾਂ ਕਿਉਂਕਿ ਦੌੜਨ ਨਾਲ ਇੱਕ ਤਾਂ ਮੇਰਾ ਸਟੈਮਿਨਾ ਬੂਸਟ ਹੁੰਦਾ ਹੈ ਅਤੇ ਮੇਰੀ ਸਿਹਤ ਤੰਦਰੁਸਤ ਰਹਿੰਦੀ ਹੈ ਤਕਰੀਬਨ ਮੈਂ ਸਵੇਰੇ ਅੱਧਾ ਘੰਟਾ ਰਨਿੰਗ ਕਰਦਾ ਹਾਂ ਅਤੇ ਸ਼ਾਮ ਨੂੰ ਵੀ ਮੈਂ ਪੰਦਰਾਂ ਤੋਂ ਵੀਹ ਮਿੰਟ ਸਮਾਂ ਬਿਤਾਉਂਦਾ ਹਾਂ ਰਨਿੰਗ ਵਿੱਚ ਮੈਂ ਆਪਣੇ ਦੋਸਤ ਨਾਲ ਸਾਡੇ ਘਰ ਦੇ ਨਾਲ ਜੋ ਗਰਾਊਂਡ ਹੈ ਉੱਥੇ ਰਨਿੰਗ ਕਰਦਾ ਹੈ ਕਿਉਂਕਿ ਇਹ ਮੇਰੀ ਸਿਹਤ ਨੂੰ ਤੰਦਰੁਸਤ ਰੱਖਦੀ ਹੈ ਅਤੇ ਮੈਂ ਆਪਣੇ ਆਪ ਨੂੰ ਫ਼ਰੈੱਸ਼ ਫ਼ੀਲ ਕਰਦਾ ਹਾਂ